ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡੀ ਕੀ ਮਦਦ ਕਰ ਸਕਦੀ ਹਾਂ ਹਾਂਜੀ ਹਾਂਜੀ ਹਾਂਜੀ ਅੱਛਾ ਅੱਛਾ ਓਕੇ ਸਰ ਹੁਣ ਤੁਸੀਂ ਇਸ ਟਾਈਮ ਕਿੱਥੇ ਆਂ ਹਿਮਾਚਲ ਤੋਂ ਆ ਕੇ ਤੁਸੀਂ ਕਿੱਥੇ ਰੁਕੇ ਆਂ ਨਵਾਂ ਸ਼ਹਿਰ ਰੁਕੇ ਆਂ ਹਾਂਜੀ ਸਰ ਪਹਿਲਾਂ ਤਾਂ ਤੁਹਾਨੂੰ ਨਵਾਂ ਸ਼ਹਿਰ ਦੇ ਵਿੱਚ ਹੀ ਬਹੁਤ ਕੁਛ ਵਧੀਆ ਦੇਖਣ ਨੂੰ ਮਿਲ ਜਾਣਾ ਹੈਗਾ ਆ ਉੱਥੇ ਸਾਡੀਆਂ ਹਿਸਟੋਰੀਕਲ ਮੋਨੂਮੈਂਟਸ ਹੈਗੇ ਆ ਠੀਕ ਹੈ ਜੀ ਐਂਡ ਉੱਥੇ ਕੋਲਜਿਸ ਯੂਨੀਵਰਸਿਟੀਜ਼ ਬਹੁਤ ਸਾਰੀਆਂ ਹੈਗੀਆਂ ਜਿਹਨਾਂ ਤੋਂ ਤੁਹਾਨੂੰ ਬਹੁਤ ਕੁਛ ਸਿੱਖਣ ਨੂੰ ਮਿਲੇਗਾ ਐਂਡ ਤੁਸੀਂ ਮਤਲਬ ਕਿ ਵਧੀਆ ਤੁਹਾਨੂੰ ਉੱਥੇ ਫੀਲ ਹੋਊਂਗਾ ਜੇ ਤੁਸੀਂ ਉੱਥੇ ਜਾਉਂਗੇ ਠੀਕ ਹੈ ਜੀ ਉਹ ਤੋਂ ਬਾਅਦ ਹੈਗਾ ਜਿਹੜਾ ਪੰਜਾਬ ਦੇ ਵਿੱਚ ਸਭ ਤੋਂ ਫੇਮਸ ਹੈਗਾ ਹੈਗਾ ਸਾਡਾ ਗੋਲਡਨ ਟੈਂਪਲ ਜਿਹੜਾ ਕਿ ਅੰਮ੍ਰਿਤਸਰ ਦੇ ਵਿੱਚ ਹੈਗਾ ਆ ਠੀਕ ਹੈ ਸਰ ਹਾਂਜੀ ਹੋਰ ਵੀ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਜਗ੍ਹਾ ਆ ਜਿੱਥੇ ਮਤਲਬ ਕਿ ਘੁੰਮ ਕੇ ਤੁਹਾਨੂੰ ਬਹੁਤ ਹੀ ਵਧੀਆ ਲੱਗੂਗਾ ਜੇ ਅਸੀਂ ਦੇਖਿਆ ਜਾਵੇ ਤਾਂ ਸਾਡੇ ਨਵਾਂ ਸ਼ਹਿਰ ਤੋਂ ਸਿਰਫ ਢਾਈ ਘੰਟੇ ਲੱਗਦੇ ਆ ਚੰਡੀਗੜ੍ਹ ਨੂੰ ਅਤੇ ਚੰਡੀਗੜ੍ਹ ਦੇ ਵਿੱਚ ਘੁੰਮਣ ਲਈ ਬਹੁਤ ਵਧੀਆ ਹੀ ਜਗ੍ਹਾ ਹੈਗੀਆਂ ਜਿੱਦਾਂ ਕਿ ਹੋ ਗਿਆ ਰੋਕ ਗਾਰਡਨ ਹਾਂਜੀ ਹਾਂਜੀ ਹਾਂਜੀ ਰੋਕ ਗਾਰਡਨ ਚੰਡੀਗੜ੍ਹ ਦੇ ਵਿੱਚ ਹੈਗਾ ਉੱਥੇ ਤੁਹਾਨੂੰ ਮਤਲਬ ਕਿ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਫਲਾਵਰਸ ਮਿਲ ਜਾਣਗੇ ਮਤਲਬ ਕਿ ਤੁਹਾਨੂੰ ਵੀ ਪਤਾ ਲੱਗੂਗਾ ਕਿਹੜੇ ਕਿਹੜੇ ਫਲਾਰਸ ਹੁੰਦੇ ਹੈਗੇ ਆ ਐਂਡ ਉੱਥੇ ਇੱਕ ਸੁਖਨਾ ਲੇਕ ਵੀ ਹੈਗੀ ਆ ਠੀਕ ਹੈ ਸਰ ਹਾਂਜੀ ਅਤੇ ਇਹ ਤੋਂ ਇਲਾਵਾ ਜੇ ਅਸੀਂ ਗੱਲ ਕਰੀਏ ਤਾਂ ਲੁਧਿਆਣਾ ਸ਼ਹਿਰ ਵੀ ਬਹੁਤ ਵਧੀਆ ਹੈਗਾ ਉੱਥੇ ਵੀ ਤੁਹਾਨੂੰ ਹਿਸਟੋਰੀਕਲ ਮੋਨੂਮੈਂਟਸ ਮਿਲ ਜਾਣੇ ਹੈਗੇ ਆ ਹਾਂਜੀ ਲੁਧਿਆਣੇ ਦੇ ਵਿੱਚ ਸਰ ਘੁੰਮਣ ਦੇ ਲਈ ਬਹੁਤ ਵਧੀਆ ਹੈਗੇ ਉੱਥੇ ਜ਼ੂ ਹੈਗੀ ਆ ਉਹਨਾਂ ਦੇ ਹਿਸਟੋਰੀਕਲ ਆਪਣੇ ਮੋਨੂਮੈਂਟਸ ਹੈਗੇ ਆ ਮਿਊਜ਼ੀਅਮ ਆ ਉੱਥੇ ਐਂਡ ਹੋਰ ਵੀ ਬਹੁਤ ਸਾਰੀਆਂ ਵਧੀਆ ਜਗ੍ਹਾ ਆ ਐਂਡ ਫਿਲੋਸ ਫਲੋਟ ਵੀ ਹੈਗਾ ਆ ਉੱਥੇ ਲੁਧਿਆਣੇ ਦੇ ਵਿੱਚ ਹਾਂਜੀ ਅਤੇ ਜਲੰਧਰ ਦੇ ਵਿੱਚ ਹਾਂਜੀ ਹਾਂਜੀ ਸਰ ਸਾਰੀਆਂ ਮਤਲਬ ਕਿ ਪੰਜਾਬ ਦੇ ਵਿੱਚ ਜਿੰਨੇ ਵੀ ਸ਼ਹਿਰ ਹੈਗੇ ਆ ਨਾ ਸਾਰੇ ਹੀ ਆਪਣੇ ਆਪਣੇ ਇਤਿਹਾਸਿਕ ਅਤੇ ਧਾਰਮਿਕ ਸਥਾਨਾਂ ਨੂੰ ਲੈ ਕੇ ਉਹਨਾਂ ਦਾ ਆਪਣਾ ਮਹੱਤਵ ਆ ਜੇ ਤੁਸੀਂ ਕਿਸੇ ਵੀ ਸ਼ਹਿਰ ਦੇ ਵਿੱਚ ਜਾਓਗੇ ਤੁਹਾਨੂੰ ਸਾਰੇ ਹੀ ਸ਼ਹਿਰਾਂ ਦੇ ਵਿੱਚ ਉੱਥੇ ਦੇ ਧਾਰਮਿਕ ਅਤੇ ਉੱਥੇ ਦੇ ਇਤਿਹਾਸਿਕ ਜਿੰਨੀਆਂ ਵੀ ਜਗ੍ਹਾਵਾਂ ਹੋਣਗੀਆਂ ਉਹਨਾਂ ਦਾ ਸਾਰਿਆਂ ਦਾ ਆਪਣਾ ਆਪਣਾ ਮਹੱਤਵ ਹੈਗਾ ਆ ਜੇ ਜੇ ਤੁਸੀਂ ਮਤਲਬ ਪੰਜਾਬ ਦੀ ਜਿਹੜੀ ਵੀ ਸਿਟੀ ਦੇ ਵਿੱਚ ਜਾਓਗੇ ਤੁਹਾਨੂੰ ਮਤਲਬ ਕਿ ਹਰੇਕ ਜਗ੍ਹਾ ਦੇ ਵਿੱਚ ਹਿਸਟੋਰੀਕਲ ਮੋਨੂਮੈਂਟਸ ਮਿਲਣਗੇ ਮਤਲਬ ਕਿ ਜਿਹੜੀਆਂ ਸਾਡੀਆਂ ਪੁਰਾਣੀਆਂ ਸਾਡੀਆਂ ਦਾਦੇ ਪੜ੍ਹਦਾਦੇ ਮਤਲਬ ਕਿ ਜਿਹੜੇ ਸਾਡੇ ਵੱਡੇ ਸੀਗੇ ਉਹਨਾਂ ਦੀਆਂ ਜਿਹੜੀਆਂ ਜਗ੍ਹਾਵਾਂ ਹੁੰਦੀਆਂ ਹੈਗੀਆਂ ਆ ਉਹਨਾਂ ਦਾ ਆਪਣੇ ਮਹੱਤਵ ਦੇ ਨਾਲ ਉਹਨਾਂ ਦੀਆਂ ਉੱਥੇ ਬਣਾਇਆ ਹੋਇਆ ਆ ਠੀਕ ਹੈ ਸਰ ਹਾਂਜੀ ਇਸ ਤੋਂ ਇਲਾਵਾ ਜੇ ਮਤਲਬ ਕਿ ਤੁਹਾਨੂੰ ਟਰੈਵਲਿੰਗ ਦਾ ਹੋਰ ਕੁਛ ਪੁੱਛਣਾ ਤਾਂ ਉਹ ਵੀ ਤੁਸੀਂ ਪੁੱਛ ਸਕਦੇ ਹੈਗੇ ਆ ਮਤਲਬ ਕਿ ਉੱਥੇ ਤੁਸੀਂ ਬਾਏ ਬੱਸ ਵੀ ਜਾ ਸਕਦੇ ਹੈਗੇ ਆ ਅਤੇ ਕਾਰ ਵੀ ਬੁੱਕ ਕਰ ਸਕਦੇ ਹੈਗੇ ਆ ਇਹ ਸਾਰੀਆਂ ਫੈਸਿਲਿਟੀਸ ਹਰੇਕ ਸਿਟੀ ਦੇ ਵਿੱਚ ਅਵੇਲੇਬਲ ਹੈਗੀਆਂ ਆ ਮਤਲਬ ਕਿ ਜੇ ਤੁਸੀਂ ਬਾਏ ਬੱਸ ਜਾਣਾ ਹੈਗਾ ਆ ਤਾਂ ਵੀ ਤੁਸੀਂ ਔਨਲਾਈਨ ਟਿਕਟ ਬੁੱਕ ਕਰਵਾ ਸਕਦੇ ਹੈਗੇ ਆ ਤੁਸੀਂ ਜੇ ਤੁਸੀਂ ਬਾਏ ਕਾਰ ਜਾਣਾ ਚਾਹੁੰਦੇ ਹੈਗੇ ਆ ਤਾਂ ਤਾਂ ਵੀ ਤੁਸੀਂ ਟਿਕਟ ਬੁੱਕ ਕਰਵਾ ਸਕਦੇ ਹੈਗੇ ਆ ਤਸੀਂ ਸਰ ਕਿਹਦੇ ਥਰੂ ਜਾਣਾ ਮਤਲਬ ਕਿ ਚਾਹੋਗੇ ਬੱਸ ਦੇ ਥਰੂ ਕਿ ਕਾਰ ਦੇ ਥਰੂ ਕਾਰ ਦੇ ਥਰੂ ਜਾਣਾ ਚਾਹੋਗੇ ਹਾਂਜੀ ਸਰ ਜੇ ਮਤਲਬ ਕਿ ਜੇ ਤੁਸੀਂ ਕਾਰ ਦੇ ਥਰੂ ਜਾਵਾਂਗੇ ਤਾਂ ਤੁਹਾਨੂੰ ਬੈਟਰ ਆ ਤੁਸੀਂ ਜਲਦੀ ਪਹੁੰਚ ਜਾਓਗੇ ਐਂਡ ਜੇ ਤੁਸ ਸਰ ਤੁਸੀਂ ਮਤਲਬ ਕਿ ਟੈਕਸੀ ਬੁੱਕ ਕਰਵਾਉਂਦੇ ਹੈਗੇ ਆ ਤਾਂ ਉਹ ਦੋ ਤਿੰਨ ਜਣੇ ਮਤਲਬ ਕਿ ਮਿਲ ਕੇ ਬੁੱਕ ਕਰਵਾ ਸਕਦੇ ਆ ਜਿਹਦੇ ਨਾਲ ਮਤਲਬ ਕਿ ਜਿਹੜੇ ਤੁਹਾਡੇ ਕਿਰਾਇਆ ਲੱਗਣਾ ਹੈਗਾ ਉਹ ਸਾਰੇ ਜਿੰਨੇ ਵੀ ਹੋਣੇ ਹੈਗੇ ਉਹਨਾਂ ਦੇ ਵਿੱਚ ਡਿਵਾਈਡ ਹੋ ਜਾਣਾ ਆ ਅਤੇ ਉਹਦਾ ਤੁਹਾਡੇ 'ਤੇ ਮਤਲਬ ਕਿ ਇੱਕ 'ਤੇ ਹੀ ਵਰਡਨ ਨਹੀਂ ਆਏਗਾ ਅਤੇ ਉਹਦੇ ਲਈ ਸਾਨੂੰ ਤੁਹਾਡਾ ਆਧਾਰ ਕਾਰਡ ਚਾਹੀਦਾ ਹੁੰਦਾ ਆ ਅਤੇ ਆਧਾਰ ਕਾਰਡ ਦੇ ਨਾਲ ਮਤਲਬ ਕਿ ਅਸੀਂ ਇਹ ਟੈਕਸੀ ਦੀ ਬੁਕਿੰਗ ਕਰਦੇ ਹਾਂ ਤੁਸੀਂ ਮੈਨੂੰ ਸਰ ਆਪਣਾ ਕੰਟੈਕ ਕੰਟੈਕਟ ਨੰਬਰ ਦੇ ਇਹ 'ਤੇ ਤੁਹਾਡੇ ਵਟਸਐਪ ਚਲਦਾ ਆ ਹਾਂਜੀ ਸਰ ਮੈਨੂੰ ਆਧਾਰ ਕਾਰਡ ਕਰ ਦਿਓ ਅਤੇ ਫਿਰ ਜੇ ਤੁਸੀਂ ਜਾਣਾ ਹੋਊਗਾ ਫ ਕਿਹੜੀ ਸਿਟੀ ਦੇ ਵਿੱਚ ਜਾਣਾ ਚਾਹੁੰਦੇ ਹੈਗੇ ਆ ਉਹਦੇ ਰਿਲੇਟਡ ਮੈਂ ਤੁਹਾਨੂੰ ਹੋਰ ਉਹਦੀ ਜਿਹੜੀ ਇਨਫੋਰਮੇਸ਼ਨ ਹੈਗੀ ਆ ਉਹ ਮੈਂ ਤੁਹਾਨੂੰ ਦੇ ਦੂਗੀ ਅਤੇ ਮੈਨੂੰ ਦੱਸ ਦਿਓ ਤੁਸੀਂ ਕਿਹਤੇ ਜਾਣਾ ਹੈਗਾ ਆ ਅਤੇ ਮੈਂ ਫਿਰ ਤੁਹਾਡੀ ਕਾਰ ਵੀ ਬੁੱਕ ਕਰਵਾ ਦੂੰਗੀ ਓਕੇ ਸਰ ਇਹ ਤੋਂ ਇਲਾਵਾ ਹੋਰ ਜੇ ਤੁਸੀਂ ਕੁਛ ਪੁੱਛਣਾ ਚਾਹੁੰਦੇ ਆ ਤਾਂ ਓਕੇ ਸਰ ਥੈਂਕ ਯੂ